ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਕੋਲ਼ੋਂ ਔਨਲਾਈਨ ਸੋਫਾ ਮੰਗਵਾਇਆ ਤੀ ਔਰ ਪੰਦਰਾਂ ਦਿਨ ਹੋ ਗਏ ਸੋੋਫਾ ਬੁੱਕ ਕਰਵਾਏ ਨੂੰ ਪਰ ਭੇਜਿਆ ਤੁਸੀਂ ਵੀਹ ਦਿਨ ਬਾਅਦ ਆ ਉਸ ਤੋਂ ਬਾਅਦ ਜਿਹੜਾ ਸੋਫਾ ਆਇਆ ਸਾਡੇ ਕੋਲ਼ ਨਾ ਤਾਂ ਉਹਦੀ ਲੱਕੜ ਚੱਜ ਦੀ ਹੈ ਅਤੇ ਨਾ ਹੀ ਦੇਖਣ ਨੂੰ ਜਿੰਨਾ ਸਾਈਜ਼ ਦਿੱਤਾ ਉਹ ਸਾਈਜ਼ ਪੂਰਾ ਆ ਨਹੀਂ ਰਿਹਾ ਕਮਰੇ ਦੇ ਵਿੱਚ ਅਤੇ ਉਹ ਤੋਂ ਬਾਅਦ ਜਿਹੜੇ ਤੁਸੀਂ ਇਹਦੀ ਕੱਪੜਾ ਲਾਇਆ ਉਹ ਵੀ ਬੇਕਾਰ ਹੈ ਦੇਖਣ ਨੂੰ ਜਮ੍ਹਾਂ ਹੀ ਭੈੜਾ ਲੱਗਦਾ ਪਰ ਜੋ ਤੁਸੀਂ ਦਿਖਾ ਰਹੇ ਹੋ ਅਤੇ ਉਹ ਚੀਜ਼ ਸਾਨੂੰ ਦਿਖ ਦਿਖੀ ਨਹੀਂ ਹੈਗੀ ਹਾਥੀ ਦੇ ਦੰਦ ਖਾਣ ਵਾਲ਼ੇ ਹੋਰ ਨੇ ਪਰ ਦਿਖਾਉਣ ਵਾਲ਼ੇ ਹੋਰ ਨੇ ਅਸੀਂ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਫੱਸ ਕੇ ਔਨਲਾਈਨ ਚੀਜ਼ਾਂ ਮੰਗਵਾਂ ਤਾਂ ਲੈਂਦੇ ਹਾਂ ਪਰ ਮੁੜ ਕੇ ਫਿਰ ਸਾਨੂੰ ਉਹ ਚੀਜ਼ ਵਧੀਆ ਨਹੀਂ ਆਉਂਦੀ ਹੈਗੀ ਫਿਰ ਜਿਹੜਾ ਰੇਟ ਤੁਸੀਂ ਬੋਲਿਆ ਉਹ ਰੇਟ ਰੇਟ ਦਾ ਫ਼ਰਕ ਆ ਉਹ ਚੀਜ਼ ਦਾ ਫ਼ਰਕ ਆ ਜਿਹੜੀ ਚੀਜ਼ ਤੁਸੀਂ ਕਹੀ ਸੀਗੀ ਔਨਲਾਈਨ ਦਿਖਾਈ ਗਈ ਹੈ ਚੀਜ਼ ਉਹ ਚੀਜ਼ ਨਹੀਂ ਸਾਨੂੰ ਮਿਲੀ ਹੈਗੀ ਅਤੇ ਜਿਹੜਾ ਬੰਦਾ ਛੱਡਣ ਆਇਆ ਉਹ ਵੀ ਬੜਾ ਵਧੀਆ ਆਕੜਖਾਨ ਸੀਗਾ ਕਹਿੰਦਾ ਆਪਣੇ ਬੰਦੇ ਆਪ ਲਿਆਓ ਜੀ ਆਪ ਹੀ ਉਤਾਰੋ ਸਾਨੂੰ ਨਹੀਂ ਸਾਨੂੰ ਇੰਨਾ ਆਡਰ ਨਹੀਂ ਹੈਗਾ ਵੀ ਅਸੀਂ ਆਵਦੇ ਦੇ ਘਰ ਤੱਕ ਅੰਦਰ ਤੱਕ ਛੱਡ ਕੇ ਆਈਏ ਇਹ ਤੋਂ ਬਾਅਦ ਆਪਣਾ ਸੋਫਾ ਲੈ ਜੋ ਭਾਈ ਜਿਹੜੇ ਪੈਸੇ ਤੁਹਾਨੂੰ ਦਿੱਤੇ ਗਏ ਨੇ ਉਹ ਸਾਨੂੰ ਵਾਪਸ ਕਰ ਦਿਉ